ਮੇਰੇ ਖਾਣੇ ਦੇ ਵਿੱਚ ਜੋ ਖਾਸ ਟੈਕਨੀਕ ਰਹਿੰਦੀ ਆ ਉਹ ਖੜ੍ਹੇ ਮਸਾਲਿਆਂ ਦੇ ਹਿਸਾਬ ਨਾਲ ਰਹਿੰਦੀ ਹੈ ਜਿਸ ਤਰ੍ਹਾਂ ਹਰੀ ਇਲਾਚੀ ਮੋਟੀ ਇਲਾਚੀ ਲੌਂਗ ਕਾਲੀ ਮਿਰਚ ਦਾਲਚੀਨੀ ਅਤੇ ਹੋਰ ਇਸ ਤਰ੍ਹਾਂ ਦੇ ਜੋ ਮਸਾਲੇ ਹਨ ਤੇਜ ਪੱਤਾ ਇਹਨਾਂ ਨੂੰ ਮੈਂ ਇੱਕ ਪਿਸਵਾ ਕੇ ਰੱਖ ਲੈਂਦੀ ਹਾਂ ਜਿਸ ਹਿਸਾਬ ਦੇ ਨਾਲ ਮੈਂ ਕੋਈ ਵੀ ਸਬਜ਼ੀ ਬਣਾਉਂਦੀ ਹਾਂ ਓਹਨਾਂ ਨੂੰ ਉਸ ਮਾਤਰਾ ਦੇ ਹਿਸਾਬ ਨਾਲ ਮੈਂ ਓਹਨਾਂ ਵਿੱਚ ਐਡ ਕਰਦੀ ਹਾਂ ਜਿਹਦੇ ਨਾਲ ਸਬਜ਼ੀ ਦਾ ਸਵਾਦ ਕਾਫੀ ਵਧੀਆ ਹੋ ਜਾਂਦਾ ਅਗਰ ਤੁਸੀਂ ਗੱਲ ਕਰੋ ਖਾਣਾ ਬਣਾਉਣ ਦੀ ਅਤੇ ਓਹਨਾਂ ਦੀ ਜ਼ਿਆਦਾ ਸਵਾਦ ਬਣਾਉਣ ਦੀ ਓਹਨਾ ਨੂੰ ਜ਼ਿਆਦਾ ਪਕਾਓ ਮਸਾਲੇ ਨੂੰ ਜਿਹਦੇ ਨਾਲ ਖਾਣਾ ਕਾਫੀ ਹਿਸਾਬ ਦੇ ਨਾਲ ਵਧੀਆ ਬਣਦਾ ਤੜਕਾ ਚੰਗੀ ਤਰਾਂ ਭੁੰਨ ਕੇ ਅਸੀਂ ਖਾਣੇ ਦਾ ਸਵਾਦ ਕਾਫੀ ਵਧੀਆ ਬਣਾ ਸਕਦੇ ਹਾਂ ਧੰਨਵਾਦ